ਹੈਲੋ ਹਾਂਜੀ ਮੈਮ ਤੁਸੀਂ ਕੌਣ ਸਤਿ ਸ਼੍ਰੀ ਅਕਾਲ ਜੀ ਜੀ ਹਾਂਜੀ ਤੁਸੀਂ ਕੌਣ ਮੈਮ ਜੀ ਓਕੇ ਮੈਮ ਜੀ ਹਾਂਜੀ ਓਕੇ ਓਕੇ ਮੈਮ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਦੱਸੋ ਮੈਮ ਕਿੱਦਾਂ ਹੈਲਪ ਚਾਹੀਦੀ ਹੈ ਹਾਂਜੀ ਹਾਂਜੀ ਹਾਂਜੀ ਮੈਮ ਆਪਾਂ ਜਿੱਦਾਂ ਜੁੱਤੀ ਆ ਲੈਣੀ ਆ ਤਾਂ ਆਪਾਂ ਜੁੱਤੀਆਂ ਵਾਲੇ ਬਾਜ਼ਾਰ ਆ ਸਾਡੇ ਪਟਿਆਲੇ ਦੇ ਵਿੱਚ ਅਦਾਲਤ ਬਾਜ਼ਾਰ ਦੇ ਵਿੱਚ ਪੈਂਦਾ ਆਪਣਾ ਉੱਥੋਂ ਆਪਾਂ ਸ਼ੋਪਿੰਗ ਕਰ ਲਾਂਗੇ ਅਤੇ ਅਦਾਲਤ ਇੱਕ ਹੈ ਅਦਾਲਤ ਬਜ਼ਾਰ ਦੇ ਵਿੱਚ ਏ ਸੀ ਮਾਰਕੀਟ ਪੈਂਦੀ ਆ ਉੱਥੇ ਬਹੁਤ ਵਧੀਆ ਮਤਲਬ ਹਰ ਤਰ੍ਹਾਂ ਦੀ ਆਪਾਂ ਨੂੰ ਫੁੱਲਕਾਰੀ ਵਗੈਰਾ ਜਿਵੇਂ ਤੁਸੀਂ ਲੈਣੀਆਂ ਨੇ ਗਿਫਟ ਕਰਨ ਲਈ ਬਹੁਤ ਵਧੀਆ ਮਤਲਬ ਘੱਟ ਰੇਟ 'ਤੇ ਆਪਾਂ ਨੂੰ ਮਿਲ ਜਾਣੀ ਹੈ ਜਿੱਦਾਂ ਵੀ ਹਾਂਜੀ ਹਾਂਜੀ ਹਾਂਜੀ ਹਾਂਜੀ ਨਹੀਂ ਨਹੀਂ ਮੈਮ ਇਹ ਇਹ ਹਾਂਜੀ ਹਾਂਜੀ ਮੈਮ ਇੱਦਾਂ ਹੀ ਨੇ ਠੀਕ ਨੇ ਰੇਟ ਬਿਲਕੁਲ ਜੇ ਤੁਹਾਨੂੰ ਨਾ ਪਤਾ ਲੱਗਿਆ ਤਾਂ ਤੁਸੀਂ ਮੈਨੂੰ ਕੋਲ ਕਰ ਲਿਓ ਆਪਾਂ ਸ਼ੋਪਿੰਗ ਕਰਨ ਚੱਲੂਗੇ ਜੀ ਫਿਰ ਓਕੇ ਮੈਮ ਵੈਲਕਮ ਵੈਲਕਮ ਓਕੇ ਜੀ ਬਾਏ ਬਾਏ